ਜਿਸ ਤਰ੍ਹਾਂ ਸਾਡੇ ਸਰੀਰ ਲਈ ਖੁਰਾਕ ਜ਼ਰੂਰੀ ਹੈ ਇਸ ਤਰ੍ਹਾਂ ਹੀ ਸਾਡੇ ਸਰੀਰ ਵਾਸਤੇ ਖੇਡਾਂ ਵੀ ਜ਼ਰੂਰੀ ਹਨ ਜੋ ਕਿ ਸਾਡੇ ਮਾਨਸਿਕ ਅਤੇ ਸਰੀਰਕ ਰੋਗਾਂ ਨੂੰ ਦੂਰ ਕਰਦੀਆਂ ਹਨ ਇਸ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਸਾਡੇ ਸਰੀਰ ਦੇ ਵਿੱਚ ਸਾਰੇ ਅੰਗਾਂ ਦੀ ਡਿਵੈਲਪਮੈਂਟ ਹੁੰਦੀ ਹੈ ਜਿਵੇਂ ਕਿ ਜਿਹੜੇ ਬੱਚੇ ਛੋਟੇ ਹੁੰਦੇ ਨੇ ਜਦੋਂ ਉਹਨਾਂ ਨੂੰ ਜੰਪਪਿੰਗ ਰਨਿੰਗ ਕਰਵਾਈ ਜਾਂਦੀ ਹੈ ਤਾਂ ਉਹਨਾਂ ਦੀ ਹੈਲਥ ਇੰਪਰੂਵ ਹੁੰਦੀ ਹੈ ਖੇਡਾਂ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ ਇਹ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਸਵਸਥ ਰਹਿਣ ਲਈ ਖੇਡਾਂ ਖੇਡਣਾ ਬਹੁਤ ਜ਼ਰੂਰੀ ਹੈ ਸਵਸਥ ਸਰੀਰ ਵਿਚ ਹੀ ਸਵਸਥ ਦਿਮਾਗ ਹੁੰਦਾ ਹੈ ਜਿਵੇਂ ਕਿ ਜਿਉਂਦੇ ਰਹਿਣ ਲਈ ਹਵਾ ਪਾਣੀ ਅਤੇ ਭੋਜਨ ਜ਼ਰੂਰੀ ਹੈ ਉਸੇ ਤਰ੍ਹਾਂ ਸਵਸਥ ਰਹਿਣ ਲਈ ਖੇਡਾਂ ਬਹੁਤ ਜ਼ਰੂਰੀ ਹਨ ਖੇਡਾਂ ਮਨੁੱਖ ਨੂੰ ਅਰੋਗ ਬਣਾਉਂਦੀਆਂ ਹਨ ਖੇਡਾਂ ਖੇਡਣ ਵਾਲੇ ਇਨਸਾਨ ਰਿਸ਼ਟ ਪੁਸ਼ਟ ਅਤੇ ਹਰ ਬਿਮਾਰੀ ਤੋਂ ਦੂਰ ਰਹਿੰਦਾ ਹੈ ਖੇਡਾਂ ਖੇਡਣ ਨਾਲ ਸਰੀਰ ਵਿੱਚ ਖੂਨ ਦਾ ਦੌਰਾ ਤੇਜ਼ ਚਲਦਾ ਰਹਿੰਦਾ ਹੈ ਮਿਹਦੇ ਦੀ ਪਾਚਨ ਸ਼ਕਤੀ ਵਧਦੀ ਹੈ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਖੇਡਾਂ ਖੇਡਣ ਨਾਲ ਇਕਾਗਰਤਾ ਬਣਦੀ ਹੈ ਜਦੋਂ ਕੋਈ ਇਨਸਾਨ ਖੇਡ ਖੇਡ ਰਿਹਾ ਹੁੰਦਾ ਹੈ ਤਾਂ ਉਹ ਸਾਰੇ ਫਿਕਰਾਂ ਝੰਜਟਾਂ ਤੋਂ ਦੂਰ ਹੁੰਦਾ ਹੈ ਅਤੇ ਉਹਦਾ ਮਨ ਸ਼ਾਂਤ ਰਹਿੰਦਾ ਹੈ ਖੇਡਾਂ ਵਿੱਚ ਉਹ ਇੰਨਾ ਮਸਤ ਹੋ ਜਾਂਦਾ ਹੈ ਕਿ ਉਸਨੂੰ ਸਭ ਕੁਛ ਭੁੱਲ ਜਾਂਦਾ ਹੈ ਇਸ ਤਰ੍ਹਾਂ ਮਨ ਦੀ ਇਕਾਗਰਤਾ ਬਣਦੀ ਹੈ ਜਿਹਨੂੰ ਕਿ ਕੰਸਟਰੇਸ਼ਨ ਕਹਿੰਦੇ ਹਨ ਜੋ ਕਿ ਸਾਡੀਆਂ ਵੱਡੀਆਂ ਵੱਡੀਆਂ ਮੁਸ਼ਕਿਲਾਂ ਹੱਲ ਕਰਨ ਵਿੱਚ ਵੀ ਸਹਾਈ ਹੁੰਦੀ ਹੈ ਖੇਡਾਂ ਮਨਪ੍ਰਚਾਵੇ ਦਾ ਇੱਕ ਬਹੁਤ ਵਧੀਆ ਸਾਧਨ ਹਨ ਖੇਡਾਂ ਖੇਡਣ ਸਮੇਂ ਅਸੀਂ ਖੁੱਲ੍ਹ ਕੇ ਹੱਸਦੇ ਹਾਂ ਖੇਡਦੇ ਹਾਂ ਸਾਡਾ ਸਰੀਰ ਸਾਰਾ ਖੁੱਲ੍ਹਦਾ ਹੈ ਹੱਸਣ ਨਾਲ ਸਾਡੇ ਫੇਫੜਿਆਂ ਦੀ ਕਸਰਤ ਹੁੰਦੀ ਹੈ ਇੱਕ ਖੁਸ਼ ਰਹਿਣ ਵਾਲੇ ਇਨਸਾਨ ਤੋਂ ਹਰੇਕ ਬਿਮਾਰੀ ਦੂਰ ਰਹਿੰਦੀ ਹੈ ਇੱਕ ਖਿਡਾਰੀ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਅਤੇ ਨਸ਼ੇ ਜ਼ਿੰਦਗੀ ਨੂੰ ਤਬਾਹ ਕਰਨ ਤੋਂ ਤਬਾਹ ਕਰ ਦਿੰਦੇ ਹਨ ਇੱਕ ਚੰਗਾ ਖਿਡਾਰੀ ਆਪ ਤਾਂ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਪਰ ਉਹ ਦੂਸਰਿਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇ ਪ੍ਰੇਰਿਤ ਕਰਦਾ ਹੈ ਜਿਹੜੇ ਖੇਡਾਂ ਖੇਡਣ ਦੇ ਨਾਲ ਕੌਮਾਂ ਜਿਉਂਦੀਆਂ ਹਨ ਜਦੋਂ ਅਸੀਂ ਆਪਣੇ ਦੇਸ਼ ਦੀ ਕੋਈ ਵੀ ਖੇਡ ਖੇਡਦੇ ਹਾਂ ਦੇਸ਼ ਦਾ ਨਾਂ ਉੱਚਾ ਕਰਦੇ ਹਾਂ ਖੇਡਾਂ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਛੋਟੇ ਹੁੰਦਿਆਂ ਦੋ ਟੀਮਾਂ ਬਣਾ ਕੇ ਖੇਡਦੇ ਸਨ ਜਿੱਥੋਂ ਕਿ ਉਹਨਾਂ ਨੇ ਸ਼ਸਤਰ ਵਿੱਦਿਆ ਸਿੱਖੀ ਖੇਡਾਂ ਦੇਸ਼ ਦੀ ਉੱਨਤੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਜਦੋਂ ਕਿਸੇ ਦੇਸ਼ ਦਾ ਖਿਡਾਰੀ ਜਿੱਤਦਾ ਹੈ ਤਾਂ ਉਹ ਆਪਣੇ ਦੇਸ਼ ਦਾ ਨਾਮ ਵਿਸ਼ਵ ਭਰ ਵਿੱਚ ਰੋਸ਼ਨ ਕਰਦਾ ਹੈ ਖੇਡਾਂ ਖੇਡਣ ਨਾਲ ਇਨਸਾਨ ਦੀ ਸ਼ਖਸੀਅਤ ਵਿੱਚ ਨਿਖਾਰ ਆਉਂਦਾ ਹੈ ਉਸ ਦਾ ਆਚਰਨ ਵਧੀਆ ਬਣਦਾ ਹੈ ਇੱਕ ਖਿਡਾਰੀ ਆਪਣੇ ਕਪਤਾਨ ਦਾ ਕਹਿਣਾ ਖਿੜੇ ਮੱਥੇ ਮੰਨਦਾ ਹੈ ਅਤੇ ਇਸ ਤਰ੍ਹਾਂ ਉਸਨੂੰ ਡਸਿਪਲਨ ਦੀ ਆਦਤ ਬਣਦੀ ਹੈ ਇਸ ਤਰ੍ਹਾਂ ਉਹਨਾਂ ਵਿੱਚ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਉਸ ਵਿੱਚ ਸੱਚ ਬੋਲਣ ਅਤੇ ਇਮਾਨ ਦੇ ਅਜਿਹੇ ਗੁਣ ਪੈਦਾ ਹੁੰਦੇ ਹਨ ਖੇਡਾਂ ਵਿੱਚ ਸਾਨੂੰ ਜਿੱਤ ਅਤੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡਾ ਮਨ ਜੇਕਰ ਜਿੱਤ ਕਾਰਨ ਖੁਸ਼ ਹੁੰਦਾ ਹੈ ਤਾਂ ਹਾਰ ਨੂੰ ਵੀ ਸਵੀਕਾਰ ਕਰਦਾ ਹੈ ਇਹ ਭਾਵਨਾ ਵਿਅਕਤੀ ਨੂੰ ਜੀਵਨ ਦੇ ਹਰ ਖੇਤਰ ਵਿੱਚ ਹਾਰ ਸਵੀਕਾਰ ਕਰਨ ਦੇ ਸਮਰੱਥ ਬਣਾਉਂਦੀ ਹੈ ਖੇਡਾਂ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਖੇਡਾਂ ਸਾਡੇ ਜੀਵਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਇਹ ਸਾਡੇ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ ਸਾਨੂੰ ਪ੍ਰਤੀ ਦਿਨ ਕੁਛ ਸਮਾਂ ਖੇਡਣ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਇਹਨਾਂ ਦੇ ਲਾਭ ਅਤੇ ਮਹੱਤਵ ਨੂੰ ਦੇਖਦੇ ਹੋਏ ਇਹਨਾਂ ਵਿੱਚ ਰੁਚੀ ਜ਼ਰੂਰ ਦਿਖਾਉਣੀ ਚਾਹੀਦੀ ਹੈ